ਅੱਜ ਕੱਲ੍ਹ ਦੀ ਦੁਨੀਆ ਵਿੱਚ ਵੀ ਟੀਮ ਵਰਕ ਤਾਂ ਇੰਨਾ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਲੋਕ ਜਦੋਂ ਕਿਤੇ ਕੰਮ ਕਰਨ ਜਾਂਦੇ ਹਨ ਤਾਂ ਉੱਥੇ ਕੰਪਨੀਆਂ ਵਾਲੇ ਵੀ ਸਭ ਤੋਂ ਪਹਿਲਾਂ ਉਹਨਾਂ ਦੇ ਟੀਮ ਵਰਕ ਨੂੰ ਦੇਖਦੇ ਹਨ ਤਾਂ ਕਿ ਉਹ ਜਦੋਂ ਇੱਥੇ ਕੰਪਨੀ ਵਿੱਚ ਕੰਮ ਕਰਨ ਆਉਣ ਤਾਂ ਉਹ ਬਾਕੀ ਲੋਕਾਂ ਨਾਲ ਚੱਜ ਨਾਲ ਗੱਲਾਂ ਕਰ ਸਕੇ ਚੱਜ ਨਾਲ ਕੋਮਨੀਕੇਟ ਕਰ ਸਕੇ ਅਤੇ ਉਹਨਾਂ ਨਾਲ ਅੱਗੇ ਗਰੋਅ ਕਰ ਸਕੇ ਅਤੇ ਕੰਪਨੀ ਨੂੰ ਵੀ ਗਰੋਅ ਕਰੇ ਟੀਮ ਵਰਕ ਤਾਂ ਇੰਨਾ ਜ਼ਿਆਦਾ ਇਮਪੋਰਟੇਂਟ ਹੈ ਕਿ ਅੱਜ ਕੱਲ੍ਹ ਉਹ ਇਨਪਰੂਵ ਕਰਨ ਵਾਸਤੇ ਤਾਂ ਲੋਕਾਂ ਨੇ ਕੋਚਿੰਗ ਸੈਂਟਰ ਵਿੱਚ ਟ੍ਰੇਨਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਲੋਕ ਅੱਜ ਕੱਲ੍ਹ ਸਮਝ ਰਹੇ ਹਨ ਕਿ ਟੀਮ ਵਰਕ ਇੰਨੀ ਜ਼ਰੂਰੀ ਨਹੀਂ ਚੀਜ਼ ਹਨ ਲੋਕ ਤਾਂ ਸਮਝਦੇ ਹਨ ਕਿ ਟੀਮ ਵਰਕ ਵਾਸਤੇ ਸਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਹੈ ਪਰ ਲੋਕ ਪਰ ਅੱਜ ਕੱਲ੍ਹ ਟੀਮ ਵਰਕ ਹੀ ਸਭ ਤੋਂ ਇੰਪੋਰਟੈਂਟ ਖੇਡ ਹਨ ਲੋਕ ਬਸ ਅੱਗੇ ਵਧੀ ਜਾਂਦੇ ਹਨ ਲੋਕ ਤਰੱਕੀ ਕਰੀ ਜਾਂਦੇ ਹਨ ਆਹ ਬਿਨਾਂ ਸੋਚੇ ਕਿ ਟੀਮ ਵਰਕ ਨਹੀਂ ਜ਼ਰੂਰੀ ਪਰ ਟੀਮ ਵਰਕ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਇਹ ਸੋਰਸ ਹੈ ਕਮਾਈ ਕਰਨ ਦਾ ਅੱਜ ਕੱਲ੍ਹ ਹਰ ਇੱਕ ਕੰਪਨੀ ਵਿੱਚ ਜੇ ਜਾਣਾ ਹੈ ਤਾਂ ਟੀਮ ਵਰਕ ਤਾਂ ਆਉਣਾ ਹੀ ਚਾਹੀਦਾ ਹਨ ਲੋਕਾਂ ਨੂੰ ਸਮਝਣਾ ਹੀ ਚਾਹੀਦਾ ਹੈ ਕਿ ਟੀਮ ਵਰਕ ਵਿੱਚ ਹੀ ਤਰੱਕੀ ਹੈ ਅਤੇ ਟੀਮ ਵਰਕ ਨਾਲ ਹੀ ਤੁਸੀਂ ਵੱਡੀ ਵੱਡੀ ਕੰਪਨੀਆਂ ਵਿੱਚ ਦਾਖਲ ਹੋ ਸਕਦੇ ਹੋ